ਸਾਡੇ ਇਲਾਕੇ ਦਾ ਸਭ ਤੋਂ ਪ੍ਰਸਿੱਧ ਸਕੂਲ ਸ਼੍ਰੀ ਗੁਰੂ ਅਰਜਨ ਦੇਵ ਸੀਨੀਅਰ ਕੰਨਿਆ ਸਕੈਂਡਰੀ ਸਕੂਲ ਹੈ ਇਸ ਦੀ ਵਿਸ਼ੇਸ਼ਤਾ ਇਹ ਹੈ ਇਸ ਵਿੱਚ ਪੰਜਾਹ ਤੋਂ ਵੀ ਵੱਧ ਕਮਰੇ ਹਨ ਅਤੇ ਇੱਕ ਖੇਡ ਦਾ ਖੁੱਲ੍ਹਾ ਮੈਦਾਨ ਹੈ ਇਸ ਵਿੱਚ ਹੋਸਟਲ ਦੀ ਵੀ ਸੁਵਿਧਾ ਹੈ ਇਸ ਵਿੱਚ ਬੱਚਿਆਂ ਨੂੰ ਵਿੱਦਿਆ ਦੇ ਨਾਲ ਨਾਲ ਖੇਡਾਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਮੈਂ ਇਸ ਸਕੂਲ ਦੀ ਸਿੱਖਿਆ ਦੀ ਗੁਣਵੱਤਾ ਤੋਂ ਸਟੂ ਸੰਤੁਸ਼ਟ ਹਾਂ ਇੱਥੋਂ ਦੇ ਅਧਿਆਪਕ ਪੜ੍ਹੇ ਲਿਖੇ ਅਤੇ ਹਰੇਕ ਵਿਸ਼ਾ ਅਧਿਆਪਕ ਆਪਣੇ ਆਪਣੇ ਵਿਸ਼ੇ ਵਿੱਚ ਮਾਹਿਰ ਹੈ ਮੈਨੂੰ ਲੱਗਦਾ ਹੈ ਕਿ ਸਿੱਖਿਆ ਦੀ ਗੁਣਵੱਤਾ ਸ਼ਹਿਰ ਦੇ ਵੱਡੇ ਅਤੇ ਛੋਟੇ ਹੋਣ 'ਤੇ ਨਿਰਭਰ ਨਹੀਂ ਕਰਦੀ ਵਧੀਆ ਆਧਾਰਭੂਤ ਢਾਂਚਾ ਅਤੇ ਵਧੀਆ ਅਧਿਆਪਕ ਮਿਲ ਕੇ ਹੀ ਕਿਸੇ ਸਕੂਲ ਨੂੰ ਵਧੀਆ ਬਣਾ ਸਕਦੇ ਹਨ